ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਜੱਗੀ ਸਵੀਟ ਤੋਂ ਗੱਲ ਕਰ ਰਹੇ ਹੋ ਨਾ ਹਾਂਜੀ ਕੱਲ੍ਹ ਨਾ ਮੇਰੀ ਬੇਟੀ ਦਾ ਬਰਡੇ ਸੀਗਾ ਅਸੀਂ ਤੁਹਾਡੇ ਕੋਲੋਂ ਖਾਣਾ ਔਡਰ ਕੀਤਾ ਸੀ ਪੰਜਾਹ ਬੰਦਿਆਂ ਦਾ ਸਰ ਅਸੀਂ ਖਾਣਾ ਤੁਸੀਂ ਬਹੁਤ ਹੀ ਅੱਛਾ ਭੇਜਿਆ ਜੋ ਜੋ ਅਸੀਂ ਮੰਗਵਾਇਆ ਗਿਆ ਸੀ ਸਾਡੇ ਵੱਲੋਂ ਉਹ ਤੁਸੀਂ ਪ੍ਰੋਪਰ ਪੈਕਿੰਗ ਕਰਕੇ ਭੇਜਿਆ ਜਿੱਦਾਂ ਅਸੀਂ ਮੰਗਵਾਇਆ ਸੀ ਜਿੱਦਾਂ ਪੀਜ਼ਾ ਬਰਗਰ ਰਸਗੁੱਲੇ ਐਂਡ ਗੁਲਾਬ ਜਾਮੁਨ ਸੀ ਦਹੀਂ ਭੱਲੇ ਉਹ ਸਾਰੀ ਜਿਹੜੀ ਅਸ ਅਸੀਂ ਮੰਗਵਾਇਆ ਸੀ ਖਾਣ ਦਾ ਸਮਾਨ ਬਹੁਤ ਹੀ ਅੱਛਾ ਸੀ ਜੋ ਸਾਡੇ ਰਿਸ਼ਤੇਦਾਰ ਨੇਵਰਸ ਆਏ ਸੀ ਉਹਨਾਂ ਨੂੰ ਬਹੁਤ ਹੀ ਪਸੰਦ ਆਇਆ ਤੁਹਾਡਾ ਖਾਣਾ ਉਹ ਤੁਹਾਡੇ ਖਾਣੇ ਦੀ ਤਾਰੀਫ ਕਰਦੇ ਮ ਥੱਕ ਨਹੀਂ ਸੀ ਰਹੇ ਕਿ ਉਹ ਵਾਰ ਵਾਰ ਸਾਡੇ ਤੋਂ ਪੁੱਛ ਰਹੇ ਸੀ ਕਿ ਤੁਸੀਂ ਖਾਣਾ ਕਿੱਥੋਂ ਔਡਰ ਕਰਕੇ ਮੰਗਵਾਇਆ ਸੀ ਅਤੇ ਸਾਨੂੰ ਦੱਸਣ ਲੱਗੇ ਵੀ ਬਹੁਤ ਖੁਸ਼ੀ ਹੋ ਰਹੀ ਸੀ ਕਿ ਅਸੀਂ ਆਪਣੇ ਪਟਿਆਲੇ ਦੇ ਜੱਗੀ ਸਵੀਟ ਤੋਂ ਮੰਗਵਾਇਆ ਅਤੇ ਉਹਨਾਂ ਨੇ ਸਾਨੂੰ ਕਿਹਾ ਕਿ ਨੈਕਸਟ ਟਾਈਮ ਜਦੋਂ ਸਾਡੇ ਕਿਤੇ ਘਰ ਕਿਸੇ ਬੱਚੇ ਦਾ ਬਰਡੇ ਜਾਂ ਕੋਈ ਵੀ ਸਾਡਾ ਫੰਕਸ਼ਨ ਹੋਏਗਾ ਘਰ ਦੇ ਵਿੱਚ ਤਾਂ ਅਸੀਂ ਜਿਹੜਾ ਖਾਣਾ ਉਹ ਜੱਗੀ ਤੋਂ ਹੀ ਔਡਰ ਕਰਾਂਗੇ ਅਤੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਕਿ ਸਾਡੇ ਸ਼ਹਿਰ ਦਾ ਜਿੱਦਾਂ ਜੱਗੀ ਸਵੀਟ ਹੈ ਵੀ ਅੱਗੇ ਵੀ ਸਾਡੇ ਰੈਲੀ ਰਿਸ਼ਤੇਦਾਰਾਂ ਨੂੰ ਬਹੁਤ ਪਸੰਦ ਆਇਆ ਤੁਹਾਡਾ ਖਾਣਾ ਸਰ ਜਿੱਦਾਂ ਅਸੀਂ ਔਡਰ ਕੀਤਾ ਸੀ ਕਣਕ ਦੀ ਰੋਟੀ ਆਈ ਮੱਕੀ ਦੀ ਰੋਟੀ ਆਈ ਜੋ ਜੋ ਅਸੀਂ ਕ ਕਿਹਾ ਸੀ ਬਿਲਕੁਲ ਉੱਦਾਂ ਹੀ ਆਇਆ ਫਰੈਸ਼ ਖਾਣਾ ਆਇਆ ਸਰ ਤੁਹਾਡੇ ਵੱਲੋਂ ਬਣ ਕੇ ਮਤਲਬ ਬਹੁਤ ਹੀ ਤਾਰੀਫ ਯੋਗ ਸੀਗਾ ਤੁਹਾਡਾ ਖਾਣਾ ਕਿ ਸਾਡੇ ਕੋਲ ਕੋਈ ਸ਼ਬਦ ਹੀ ਨਹੀਂ ਕਿ ਅਸੀਂ ਉਹਦੀ ਤਾਰੀਫ ਕ ਕਰਨ ਲਈ ਅੱਗੇ ਖਤਮ ਹੀ ਨਹੀਂ ਹੋਇਆ ਸਰ ਮੈਂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਨੂੰ ਐਨਾ ਅੱਛਾ ਖਾਣਾ ਪ੍ਰੋਵਾਈਡ ਕਰਵਾਇਆ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਸਰ